ਸਰਕਾਰ ਖਿਡਾਰੀਆਂ ਦੀ ਯੋਗਤਾ ਨੂੰ ਸੁਧਾਰਨ ਲਈ ਉਹਨਾਂ ਨੂੰ ਯੂਨੀਫੋਮਾ ਵਰਦੀਆਂ ਦਿੰਦੀ ਹੈ ਉਹਨਾਂ ਨੂੰ ਨਵੇਂ ਬੈਟ ਦਿੰਦੀ ਹੈ ਸਾਰੀ ਬੈਟ ਦੇ ਨਾਲ ਦੁਨੀਆਂ ਸਾਰੀਆਂ ਕਿੱਟਾਂ ਦਿੰਦੀ ਹੈ ਕ੍ਰਿਕਟ ਦੀਆਂ ਉਹਨਾਂ ਨੇ ਜੋ ਜੋ ਵੀ ਖੇਡਣ ਦਾ ਹੁੰਦਾ ਸਾਧਨ ਸਾਰਾ ਉਹਨਾਂ ਨੂੰ ਪ੍ਰਬੰਧ ਕਰਕੇ ਦਿੰਦੀ ਹੈ ਸਰਕਾਰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਹੈ ਤੇ ਸਰਕਾਰੀ ਸਹੂਲਤਾਂ ਦਾ ਲਾਭ ਬੱਚੇ ਚੱਕਦੇ ਹਨ ਖੂਬ ਚੱਕਦੇ ਹਨ ਤੇ ਵੱਡੇ ਵੀ ਚੱਕਦੇ ਹਾਂ ਖੂਬ ਸਰਕਾਰੀ ਸਹੂਲਤਾਂ ਦਾ ਕਿਉਂਕਿ ਉਹਨਾਂ ਨੂੰ ਖੇਡਣ ਦਾ ਮੌਕਾ ਮਿਲਿਆ ਹੈ ਤੇ ਉਹ ਖੂਬ ਸੋਹਣੀ ਤਰਾਂ ਨਾਲ ਖੇਡਦੇ ਹਨ ਤੇ ਅੱਵਲ ਵੀ ਆਉਂਦੇ ਹਨ ਤੇ ਆਪਣਾ ਲੈਵਲ ਉੱਚਾ ਲੈ ਕੇ ਜਾਂਦੇ ਹਨ ਸਰਕਾਰ ਨੇ ਵੀ ਉਹਨਾਂ ਨੂੰ ਬਹੁਤ ਉੱਚਾ ਲੈਵਲ ਦੇ ਦਿੱਤਾ ਗਿਆ ਹੈ ਕਿ ਬਹੁਤ ਸਹਾਇਤਾ ਸਰਕਾਰ ਇਹਨਾਂ ਦੀ ਬੱਚਿਆਂ ਦੀ ਵੱਡਿਆਂ ਦੀ ਸਭ ਦੀ ਕਰਦੀ ਹੈ ਸਹਾਇਤਾ ਜਿਹਦੇ ਨਾਲ ਕੀ ਕੀ ਬੱਚੇ ਬਹੁਤ ਪ੍ਰਸੰਨ ਤੇ ਖੁਸ਼ ਹੈਗੇ ਨੇ ਕਿ ਆਪਣਾ ਖੇਡਾਂ ਦੇ ਵਿੱਚ ਰੁਚੀ ਬਣਾਈ ਹੋਈ ਹੈ ਤੇ ਵੱਡਿਆਂ ਨੇ ਵੀ ਅਕੈਡਮੀਆਂ ਜਾ ਜਾ ਕੇ ਆਪਣਾ ਜਿਹੜਾ ਕਿੱਟ ਵਗੈਰਾ ਮਿਲ ਗਈ ਉਹਨਾਂ ਨੂੰ ਸਭ ਕੁਝ ਮਿਲਦਾ ਵੈ ਉਹਦੇ ਵਿੱਚ ਆਪਣੀ ਰੁਚੀ ਬਣਾ ਕੇ ਐਤਵਾਰ ਵਾਲੇ ਦਿਨ ਸਵੇਰੇ ਸਾਰੇ ਵੱਡੇ ਲੋਕ ਵੀ ਜਿੱਦਾਂ ਸਾਡੇ ਕਾਰ ਵਾਲੇ ਭਰਾ ਸਭ ਆਂਢ ਗੁਆਂਢ ਇਕੱਠੇ ਹੋ ਕੇ ਆਪਣਾ ਖੇਡਣ ਨਹੀਂ ਜਾਂਦੇ ਹਨ ਧੰਨਵਾਦ